ਨਵੇਂ ਜੰਮੇ ਬੱਚੇ ਨੂੰ ਇੱਕ ਸਵੱਛ ਵਾਤਾਵਰਨ ਦੇਣ ਦੀ ਗੱਲ ਇਹ ਤੁਸੀਂ ਬੜੀ ਵਧੀਆ ਪੁੱਛੀ ਹੈ ਕਿਉਂਕਿ ਇਹ ਇਹੋ ਹੀ ਕੰਮ ਮੇਰੇ ਨਾਲ ਥੋੜ੍ਹੇ ਦਿਨ ਪਹਿਲੇ ਹੀ ਮੇਰੀ ਮੇਰੇ ਬੇਟੇ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਅਤੇ ਮੇਰੀ ਨੂੰਹ ਦੇ ਜਿਸ ਤਰ੍ਹਾਂ ਸਾਫ ਸਫਾਈ ਮੈਂ ਉਹਦੇ ਨਾਲ ਪੂਰਾ ਉਹਦਾ ਧਿਆਨ ਰੱਖਿਆ ਜੇ ਕੋਈ ਤੁਹਾਡੇ ਘਰ ਵੀ ਆਉਂਦਾ ਸੀ ਅਤੇ ਮੈਂ ਵੱਡੀ ਹੋਣ ਕਰਕੇ ਆਪਣੇ ਘਰ 'ਚੋਂ ਸਭ ਤੋਂ ਵੱਡੀ ਮੈਂ ਵਾ ਅਤੇ ਇਸ ਕਰਕੇ ਮੈਂ ਜਿਹੜਾ ਵੀ ਕੋਈ ਆਉਂਦਾ ਸੀ ਸਾਡੇ ਘਰ ਇਹੀ ਓ ਮੈਂ ਕਹਿਣਾ ਕਿ ਹੱਥ ਧੋ ਕੇ ਇਸ ਕਮਰੇ 'ਚ ਜੇ ਬੱਚੇ ਦੇ ਕੋਲ ਆਉਣਾ ਅਤੇ ਹੱਥ ਧੋ ਕੇ ਸੈਨੀਟਾਈਜ ਕਰਕੇ ਆਓ ਜੇ ਚੁੱਕਣਾ ਬੱਚੇ ਨੂੰ ਉਹਦੇ ਬੱਚੇ ਦੇ ਮੂੰਹ 'ਤੇ ਪਾਰੀ ਨਹੀਂ ਕਰਨੀ ਕਿਉਂਕਿ ਬੱਚੇ ਨੂੰ ਬੜੀ ਛੇਤੀ ਜੇ ਕਿਸੇ ਨੂੰ ਖਾਂਸੀ ਵਗੈਰਾ ਵੀ ਹੋਵੇ ਤਾਂ ਬੱਚਾ ਬੜੀ ਜਲਦੀ ਕੈਚ ਕਰਦਾ ਵੇ ਛੋ ਵੱਡੇ ਤਾਂ ਬੜੀ ਛੇਤੀ ਕਵਰ ਕਰ ਲੈਂਦੇ ਨੇ ਪਰ ਬੱਚੇ ਤੋਂ ਨੂੰ ਠੀਕ ਬੱਚਾ ਜੇ ਬਿਮਾਰ ਹੋ ਜਾਏ ਤਾਂ ਬਹੁਤ ਮੁਸ਼ਕਿਲ ਹੁੰਦੀ ਹੈ ਇਸ ਵਾਸਤੇ ਅਸੀਂ ਆਪ ਹੀ ਧਿਆਨ ਰੱਖਣਾ ਹੁੰਦਾ ਵੇ ਭਾਵੇਂ ਇਸ ਗੱਲ ਤੋਂ ਮੇਰੇ ਨਾਲ ਕਈ ਨਰਾਜ਼ ਵੀ ਹੋਏ ਨੇ ਕਿ ਇਹ ਬਹੁਤ ਜ਼ਿਆਦਾ ਸਫਾਈ ਦਾ ਧਿਆਨ ਰੱਖਦੀ ਹੈ ਪਰ ਕੋਈ ਗੱਲ ਨਹੀਂ ਬੱਚੇ ਪਿੱਛੇ ਭਾਵੇਂ ਸਾਨੂੰ ਕਿਸੇ ਕੋਲੋਂ ਗੱਲਾਂ ਵੀ ਸੁਣਨੀਆਂ ਪੈਣ ਤਾਂ ਸਾਨੂੰ ਕੋਈ ਮੁਸ਼ਕਿਲ ਨਹੀਂ ਹੈਗੀ ਕੋਈ ਗੱਲ ਨਹੀਂ ਬੱਚਾ ਤੰਦਰੁਸਤ ਹੋਵੇ ਅਤੇ ਸਾਫ ਸੁਥਰਾ ਹੋਵੇ ਬਸ ਬੱਚਾ ਬਿਮਾਰ ਨਾ ਹੋਵੇ ਧੰਨਵਾਦ ਜੀ